ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਅਤੇ ਬਹੁਤ ਵਾਰ ਕੁਛ ਨਾ ਕੁਛ ਜਿੱਤੀ ਹੀ ਹਾਂ ਮੈਂ ਆਪਣੀ ਕਲਾਕਾਰੀ ਜਿਆਦਾ ਤੌਰ ਉਤੇ ਚਿੱਤਰਕਾਰੀ ਵਿੱਚ ਹੀ ਦਿਖਾਈ ਹੈ ਮੇਰੇ ਲਈ ਇਸਦਾ ਅਨੁਭਵ ਹਰ ਵਾਰ ਬਹੁਤ ਹੀ ਅਲੱਗ ਰਹਿੰਦਾ ਹੈ ਕਈ ਵਾਰ ਤਾਂ ਬਹੁਤ ਹੀ ਚੰਗਾ ਅਤੇ ਕਈ ਵਾਰ ਬਹੁਤ ਹੀ ਮਾੜਾ ਕਈ ਵਾਰ ਮੈਂ ਆਪਣੇ ਕਾਲਜ ਅਤੇ ਸਕੂਲ ਵੱਲੋਂ ਗਈ ਹਾਂ ਅਤੇ ਕਈ ਵਾਰ ਆਪਣੇ ਤੌਰ ਉੱਤੇ ਇਸਦੇ ਵਿੱਚ ਅਸੀਂ ਜਦ ਭਾਗ ਲੈਂਦੇ ਹਾਂ ਤਾਂ ਹਰ ਥਾਂ ਦੇ ਆਪਣੇ ਆਪਣੇ ਤੌਰ ਤਰੀਕੇ ਹੁੰਦੇ ਹਨ ਕਈ ਕਹਿੰਦੇ ਹਨ ਕਿ ਅਸੀਂ ਉੱਥੇ ਹੀ ਚਿੱਤਰ ਬਣਾਉਣਾ ਹੈ ਅਤੇ ਕਈ ਵਾਰ ਅਸੀਂ ਬਣਾ ਕੇ ਲੈ ਕੇ ਜਾਣਾ ਹੁੰਦਾ ਹੈ ਇਸ ਤਰ੍ਹਾਂ ਮੈਨੂੰ ਆਪਣੀ ਪ੍ਰਦਰਸ਼ਨੀ ਪ੍ਰਸਤੁਤ ਕਰਨ ਵਿੱਚ ਬਹੁਤ ਹੀ ਆਨੰਦ ਆਉਂਦਾ ਹੈ ਇਸ ਕਾਰਨ ਅਸੀਂ ਨਵੇਂ ਲੋਕਾਂ ਨਾਲ ਮਿਲਦੇ ਹਾਂ ਅਤੇ ਉਹਨਾਂ ਨਾਲ ਦੋਸਤੀ ਵੀ ਹੁੰਦੀ ਹੈ ਤਾਂ ਕਈ ਵਾਰ ਨਈ ਚੀਜ਼ਾਂ ਸਿੱਖਣ ਦਾ ਮੌਕਾ ਮਿਲਦਾ ਹੈ ਅਤੇ ਦੁਨੀਆ ਭਰ ਵਿੱਚ ਸਾਨੂੰ ਨਵੀਂ ਨਵੀਂ ਚੀਜ਼ਾਂ ਦੇ ਬਾਰੇ ਅਨੁਭਵ ਕਰਨਾ ਚਾਹੀਦਾ ਹੈ ਅਤੇ ਉਹ ਸਾਡੇ ਲਈ ਬਹੁਤ ਚੰਗਾ ਹੁੰਦਾ ਹੈ